ਦੇਖੋ ਪਿਛਲੇ ਸਮੇਂ ਵਿੱਚ ਪਾਣੀ ਦੀ ਘਾਟ ਬਹੁਤ ਏ ਜ਼ਿਆਦਾ ਹੁੰਦੀ ਸੀ ਸਾਡੇ ਪਿੰਡ ਵਿੱਚ ਵੀ ਕਿਤੇ ਕਿਤੇ ਹੀ ਖੂਹ ਹੁੰਦੇ ਸਨ ਅਤੇ ਹੋਰ ਪਿੰਡਾਂ ਵਿੱਚ ਵੀ ਇਸ ਨਾਲ਼ ਫਸਲ ਦੇ ਵਿੱਚ ਵੀ ਬ ਬਹੁਤ ਘਾਟਾ ਹੁੰਦਾ ਸੀ ਅੱਜ ਕੱਲ੍ਹ ਕੀ ਹੋ ਰਿਹਾ ਥਾਂ ਥਾਂ 'ਤੇ ਮੋਟਰਾਂ ਲੱਗ ਚੁੱਕੀਆਂ ਹਨ ਹਰੇਕ ਦੇ ਘਰ ਸਮਰਸੀਬਲ ਟੂਲ ਪੰਪ ਲੱਗ ਚੁੱਕੇ ਹਨ ਅੱਜ ਕੱਲ੍ਹ ਪਾਣੀ ਦੀ ਘਾਟ ਬਿਲਕੁਲ ਨਹੀਂ ਹੈ ਪਾਣੀ ਦੀ ਘਾਟ ਪਿਛਲੇ ਸਮੇਂ ਵਿੱਚ ਹੁੰਦੀ ਸੀ ਅੱਜ ਕੱਲ੍ਹ ਬਿਲਕੁਲ ਪਾਣੀ ਦੀ ਘਾਟ ਮਹਿਸੂਸ ਨਹੀਂ ਹੁੰਦੀ ਅੱਜ ਕੱਲ੍ਹ ਕਿਸੇ ਨੂੰ ਵੀ ਪਾਣੀ ਦੀ ਘਾਟ ਨਹੀਂ ਪਹਿਲਾਂ ਸੋਕਾ ਪਿਆ ਰਹਿੰਦਾ ਸੀਗਾ ਕਣਕ ਜੀਰੀ ਦੀ ਪੈਦਾਵਾਰ ਵਿੱਚ ਬਹੁਤਾ ਵਾਧਾ ਨਹੀਂ ਸੀ ਹੁੰਦਾ ਕਿਉਂਕਿ ਪਾਣੀ ਦੀ ਘਾਟ ਕਾਰਨ ਕਾਰਨ ਖੇਤਾਂ ਵਿੱਚ ਅਕਸਰ ਹੀ ਸੋਕਾ ਪਿਆ ਰਹਿੰਦਾ ਸੀ ਕਿਤੇ ਕਿਤੇ ਖੂਹ ਹੋਣ ਕਰਕੇ ਸਾਡੇ ਪਿੰਡ ਦੀਆਂ ਪੁਰਾਣੀਆਂ ਬਜ਼ੁਰਗ ਔਰਤਾਂ ਖੂਹਾਂ ਵਿੱਚੋਂ ਪਾਣੀ ਲੈਣ ਜਾਂਦੀਆਂ ਸੀਗੀਆਂ ਸਾਡੇ ਪਿੰਡ ਕਿਤੇ ਕਿਤੇ ਹੀ ਨਲਕਾ ਹੁੰਦਾ ਸੀ ਇਸ ਨਾਲ਼ ਬਹੁਤ ਹੀ ਜ਼ਿਆਦਾ ਅਸਰ ਪਿਆ ਅੱਜ ਕੱਲ੍ਹ ਬਿਲਕੁਲ ਹੀ ਸੋਕਾ ਨਹੀਂ ਕਿਤੇ ਵੀ ਨਹੀਂ ਹੈ ਸੋਕਾ ਕਿਉਂਕਿ ਹਰੇਕ ਦੇ ਖੇਤਾਂ ਵਿੱਚ ਮੋਟਰਾਂ ਲੱਗ ਚੁੱਕੀਆਂ ਹਨ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ ਫਸਲ ਵਿੱਚ ਝਾੜ ਜ਼ਿਆਦਾ ਆਉਂਦਾ ਹੈ ਅੱਜ ਕੱਲ੍ਹ ਹਰੇਕ ਦੇ ਘਰ ਹੀ ਮੋਟਰਾਂ ਲੱਗ ਚੁੱਕੀਆਂ ਹਨ ਇਸ ਅੱਜ ਕੱਲ੍ਹ ਪਾਣੀ ਬਹੁਤ ਜ਼ਿਆਦਾ ਹੈ ਕਿਸੇ ਨੂੰ ਪਾਣੀ ਦੀ ਘਾਟ ਮਹਿਸੂਸ ਨਹੀਂ ਹੁੰਦੀ